ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਜੀ ਅਸੀਂ ਪਹਿਲੇ ਤਾਂ ਤੁਹਾਡਾ ਵੈੱਲਕਮ ਕਰਦੇ ਹਾਂ ਤੁਸੀਂ ਸਾਡੇ ਪੰਜਾਬ ਵਿੱਚ ਘੁੰਮਣ ਲਈ ਆ ਰਹੇ ਹੋ ਸਭ ਤੋਂ ਪਹਿਲੇ ਤਾਂ ਮੈਂ ਸਭ ਤੋਂ ਪਹਿਲੇ ਤੁਹਾਨੂੰ ਪ੍ਰੈਫਰੈਂਸ ਦਊਂਗੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ ਅਤੇ ਉੱਥੇ ਗੌਲਡਨ ਟੈਂਪਲ ਘੁੰਮੋ ਅਤੇ ਅਸੀਂ ਤੁਹਾਨੂੰ ਉੱਥੇ ਪੂਰੀ ਜਿਹੜੀ ਹੈਗੈ ਦਿਖਾਵਾਂਗੇ ਅਤੇ ਨਾਲ਼ ਹੀ ਆਪਣੇ ਮੰਦਰ ਹੈਗੇ ਹੈ ਉੱਥੇ ਚੈੱਕ ਦਿਖਾਵਾਂਗੇ ਜੀ ਔਰ ਜੋ ਕਾਫ਼ੀ ਸਾਰੇ ਹੈ ਫਿਰ ਅਸੀਂ ਤੁਹਾਨੂੰ ਚੰਡੀਗੜ੍ਹ ਲੈ ਕੇ ਜਾਵਾਂਗੇ ਚੰਡੀਗੜ੍ਹ ਬਹੁਤ ਸਾਰੀਆਂ ਐਸੀ ਜਗ੍ਹਾ ਹੈਗੀਆਂ ਰੌਕ ਗਾਰਡਨ ਹੈ ਚੱਪ ਚੱਪੜ ਚਿੜੀ ਲੈ ਕੇ ਜਾਵਾਂਗੇ ਬਹੁਤ ਸਾਰੀਆਂ ਇਹੇ ਜਿਹੀਆਂ ਚੀ ਜਗ੍ਹਾ ਹੈਗੀਆਂ ਜਿਹੜਾ ਤੁਹਾਨੂੰ ਬਹੁਤ ਹੀ ਮਤਲਬ ਪੀਸਫੁਲੀ ਜਿਹੜਾ ਹੈਗਾ ਤੁਹਾਨੂੰ ਪੰਜਾਬ ਨੂੰ ਘੁੰਮਣ ਦਾ ਮੌਕਾ ਦੇਵਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਜਿਹੜੇ ਹੈਗੇ ਹੈ ਆਪਣੇ ਸਾਹਿਬਜ਼ਾਦਿਆਂ ਸਾਹਿਬਜ਼ਾਦਿਆਂ ਦਾ ਮੇਨ ਜਿਹੜਾ ਗੁਰਦੁਆਰੇ ਹੈਗੇ ਹੈ ਅਤੇ ਜੋਤੀ ਸਰੂਪ ਹੈ ਆਪਾਂ ਉੱਥੇ ਤੁਹਾਨੂੰ ਲੈ ਕੇ ਜਾਵਾਂਗੇ ਰੋਪੜ ਹੈਗੇ ਹੈ ਰੋਪੜ ਦੇ ਏਰੀਏ ਦੇ ਵਿੱਚ ਆਪਣੇ ਬਹੁਤ ਗੁਰਦੁਆਰੇ ਹੈਗੇ ਹੈ

ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਮੇਨ ਹੈਗਾ ਜਿੱਥੇ ਤੁਹਾਨੂੰ ਅਸੀਂ ਬਹੁਤ ਅੱਛੇ ਜਿਹੜੇ ਹੈਗੇ ਹੈ ਬਹੁਤ ਜਗ੍ਹਾ 'ਤੇ ਘੁੰਮਾ ਸਕਦੇ ਅਨੰਦਪੁਰ ਸਾਹਿਬ ਜਿਹੜਾ ਹੈਗਾ ਆਪਣਾ ਹੋਲੇ ਮਹੱਲੇ ਦਾ ਸਭ ਤੋਂ ਫੇਮੱਸ ਜਿਹੜਾ ਹੈਗਾ ਟੂਰਿਜ਼ਮ ਉੱਥੇ ਜਾਂਦੇ ਹੈਗੇ ਆ ਬਹੁਤ ਵਧੀਆ ਤੁਹਾਡਾ ਉੱਥੇ ਉਹ ਰਹੇਗਾ ਜੀ ਜੀ ਜੀ ਬਿਲਕੁਲ ਸਰ ਅਸੀਂ ਤੁਹਾਡਾ ਸਵਾਗਤ ਕਰਾਂਗੇ ਜਦੋਂ ਵੀ ਤੁਸੀਂ ਸਾਨੂੰ ਇਸ ਚੀਜ਼ ਦਾ ਮੌਕਾ ਦਉਂਗੇ ਤਾਂ ਥੈਂਕ ਯੂ ਥੈਂਕ ਯੂ ਸਰ